ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਤੁਸੀਂ ਹੈਪੀ ਸ਼ੋਪ ਤੋਂ ਬੋਲਦੇ ਹੋ ਜੀ ਤੁਹਾਡਾ ਦਿੱਤਾ ਹੋਇਆ ਫ਼ੋਨ ਮੈਨੂੰ ਮਿਲ ਗਿਆ ਹੈ ਜੀ ਮੈਨੂੰ ਅੱਜ ਹੀ ਡਿਲੀਵਰੀ ਮਿਲੀ ਹੈ ਜੀ ਅਤੇ ਤੁਹਾਡਾ ਇਹ ਮੋਬਾਇਲ ਦਾ ਸਭ ਤੇ ਪਹਿਲਾਂ ਤਾਂ ਕਲਰ ਬਹੁਤ ਵਧੀਆ ਹੈ ਜੀ ਵਾਈਟ ਕਲਰ ਅਤੇ ਮੇਨ ਗੱਲ ਇਹ ਹੈ ਵੀ ਇਹ ਚੱਲਦਾ ਹੀ ਬਹੁਤ ਸੋਹਣਾ ਹੈ ਇਸਦੀ ਕੁਆਲਟੀ ਹੈ ਜਿਹੜੀ ਸਭ ਤੇ ਉੱਪਰ ਹੈ ਜੀ ਇਹਦੇ ਜੇ ਅ ਗੂਗ ਅ ਗੂਗਲ ਵੱਟਸਅੱਪ ਫੇਸਬੁੱਕ ਸਭ ਕੁਛ ਬਹੁਤ ਵਧੀਆ ਚੱਲਦਾ ਹੈ ਜੀ ਸਪੀਕਰ ਇਹਦੇ ਬਹੁਤ ਵਧੀਆ ਹੈ ਜੀ ਹਰੇਕ ਚੀਜ਼ ਕੁਆਲਟੀ ਵਾਲੀ ਹੈ ਜੀ ਹੋ ਸਕੇ ਜੇ ਤੁਹਾਨੂੰ ਕੋਈ ਹੋਰ ਵੀ ਮਿਲ ਫ਼ੋਨ ਹੋਵੇ ਤਾਂ ਤੁਸੀਂ ਮੈਨੂੰ ਜ਼ਰੂਰ ਦੱਸਿਓ ਜੀ ਮੈਂ ਉਹ ਵੀ ਲਉਂਗੀ ਜੀ ਅਤੇ ਹੋਰਾਂ ਨੂੰ ਦਵਾਉਂਗੀ ਜੀ ਥੈਂਕ ਯੂ ਵੈਰੀ ਮੱਚ